ਟੁੱਟਦੇ ਤਾਰੇ ਨੂੰ ਦੇਖ ਕੇ ਇੱਕ ਵਿਸ਼ ਮੰਗਣਾ ਇੱਕ ਬਹੁਤ ਵਧੀਆ ਗੱਲ ਹੈ ਇਸ ਤੋਂ ਬਿਨਾਂ ਇਹ ਵੀ ਦੱਸਿਆ ਸਾਡੇ ਛੋਟੇ ਬੱਚਿਆਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਜਦੋਂ ਵੀ ਕੋਈ ਸਾਡਾ ਆਪਣਾ ਸਾਡੇ ਤੋਂ ਵਿਛੜ ਕੇ ਦੂਰ ਜਾਂਦਾ ਹੈ ਤਾਂ ਉਹ ਤਾਰਾ ਬਣ ਕੇ ਸਾਨੂੰ ਦੇਖਦਾ ਰਹਿੰਦਾ ਹੈ